ਸਾਡੇ ਬ੍ਰਹਿਮੰਡ ਵਿੱਚ ਬਹੁਤ ਸਾਰੀਆਂ ਗਲੈਕਸੀਆਂ ਹਨ ਪਰ ਸਾਡੀ ਗਲੈਕਸੀ ਦਾ ਨਾਮ ਮਿਲਕੀ ਵੇ ਗਲੈਕਸੀ ਹੈ ਇਸ ਵਿੱਚ ਨੌਂ ਪਲੈਨਟ ਹੁੰਦੇ ਸਨ ਪਰ ਅੱਜ ਕੱਲ੍ਹ ਇਸ ਵਿੱਚ ਸਿਰਫ ਅੱਠ ਹੀ ਰਹਿ ਗਏ ਹਨ ਕਿਉਂਕਿ ਪਲੂਟੋ ਨੂੰ ਇਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਕਿਉਂਕਿ ਇਸ ਨੂੰ ਮ੍ਰਿਤਕ ਤਾਰਾ ਘੋਸ਼ਿਤ ਕਰ ਦਿੱਤਾ ਗਿਆ ਸੀ ਇਸ ਵਿੱਚ ਲਾਲ ਗ੍ਰਹਿ ਜਿਸ ਨੂੰ ਮਾਰਸ ਕਿਹਾ ਜਾਂਦਾ ਉਹ ਵੀ ਹੈ ਇਸ ਵਿੱਚ ਜੁਪੀਟਰ ਜੋ ਕਿ ਸਭ ਤੋਂ ਵੱਡਾ ਪਲੈਨਟ ਹੈ ਉਹ ਵੀ ਹੈ ਇਸ ਤੋਂ ਇਲਾਵਾ ਇਸ ਵਿੱਚ ਸੈਟਰਨ ਹੈ ਜਿਸ ਦੇ ਆਲੇ ਦੁਆਲੇ ਰਿੰਗਸ ਹਨ ਅਤੇ ਇਸ ਤੋਂ ਇਲਾਵਾ ਇਸ ਵਿੱਚ ਨੈਪਚੂਨ ਹੈ ਜਿਸ ਨੂੰ ਸਭ ਤੋਂ ਵ ਵੱਧ ਚਮਕਣ ਵਾਲਾ ਤਾਰਾ ਜਾਂ ਗ੍ਰਹਿ ਕਿਹਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਇਸ ਵਿੱਚ ਧਰਤੀ ਹੈ ਜੋ ਕਿ ਮੇਰਾ ਸਭ ਤੋਂ ਮਨ ਪਸੰਦ ਗ੍ਰਹਿ ਹੈ ਇਸ ਉੱਤੇ ਸੱਤਰ ਪ੍ਰਸੈਂਟ ਪਾਣੀ ਹੈ ਅਤੇ ਤੀਹ ਪ੍ਰਸੈਂਟ ਧ ਧਰਤੀ ਹੈ ਅਤੇ ਜਿਸ ਉੱਤੇ ਲੋਕ ਅਤੇ ਜਾਨਵਰ ਆਦਿ ਰਹਿੰਦੇ ਹਨ ਇਸ ਤੋਂ ਉੱਤੇ ਹਵਾ ਪਾਣੀ ਅਤੇ ਧਰਤੀ 'ਤੇ ਨਾ ਉੱਤੇ ਜੀਵ ਜੰਤੂ ਰਹਿੰਦੇ ਹਨ ਜੋ ਕਿ ਮਾਸਾਹਾਰੀ ਅਤੇ ਸ਼ਾਕਾਹਾਰੀ ਦੋਵੇਂ ਪ੍ਰਕਾਰ ਦੇ ਪਾਏ ਜਾਂਦੇ ਹਨ ਅਤੇ ਇਸ ਇਹ ਮੈਨੂੰ ਇਸ ਕਰਕੇ ਪਸੰਦ ਹੈ ਕਿਉਂਕਿ ਇੱਥੇ ਬਹੁਤ ਸਾਰੀ ਹਰੇਵਾਈ ਹੈ ਇੱਥੇ ਪਹਿਲਾਂ ਦੇ ਜ਼ਮਾਨੇ ਵਿੱਚ ਜਦੋਂ ਇਨਸਾਨ ਆਪਣੇ ਸ਼ੁਰੂਆਤੀ ਦੌਰ ਵਿੱਚ ਸੀ ਜਦੋਂ ਜਿਹਨਾਂ ਨੂੰ ਹੋਮੋਸੇਪੀਅਨ ਵੀ ਕਿਹਾ ਜਾਂਦਾ ਹੈ ਉਹ ਉਹਨਾਂ ਨੂੰ ਉਹਨਾਂ ਕੋਲ ਕੋਈ ਕਿਸੇ ਪ੍ਰਕਾਰ ਦੀ ਕੋਈ ਵੀ ਚੀਜ਼ ਨਹੀਂ ਸੀ ਉਹਨਾਂ ਕੋਲ ਅੱਗ ਤੱਕ ਬਾਲਣ ਵਾਸਤੇ ਕੋਈ ਚੀਜ਼ ਨਹੀਂ ਸੀ ਅਤੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿਵੇਂ ਅੱਗ ਆਦਿ ਬਾਲੀ ਆਉਂਦੀ ਹੈ ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਉਹਨਾਂ ਨੇ ਤਰੱਕੀ ਕੀਤੀ ਉਵੇਂ ਉਵੇਂ ਇੱਥੇ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਜਿਵੇਂ ਕਿ ਉਦੋਂ ਜ਼ਮਾਨੇ ਵਿੱਚ ਅੱਗ ਬਾਲਣਾ ਵੀ ਬਹੁਤ ਮਿਹਨਤ ਦਾ ਕੰਮ ਹੁੰਦਾ ਸੀ ਅੱਜ ਕੱਲ੍ਹ ਤਾਂ ਅੱਜ ਕੱਲ੍ਹ ਏਜੰਸੀਆਂ ਆਦਿ ਚੰਨ ਆਦਿ ਚੰਨ ਅਤੇ ਮਾਰਸ ਆਦਿ ਵਰਗੇ ਗ੍ਰਹਿ ਉੱਤੇ ਵੀ ਜਾ ਸਕਦੇ ਹਨ ਅੱਜ ਕੱਲ੍ਹ ਇੰਨੀ ਇਨਸਾਨ ਨੇ ਤਰੱਕੀ ਕਰ ਲਈ ਹੈ ਕਿ ਉਹ ਵੱਖ ਵੱਖ ਗ੍ਰਹਿਆਂ 'ਤੇ ਜਾ ਸਕਦਾ ਹੈ ਅਤੇ ਸੈਟਲਾਈਟ ਆਦਿ ਛੱਡ ਸਕਦਾ ਹੈ ਚੰਦ 'ਤੇ ਜਾਣਾ ਤਾਂ ਅੱਜ ਕੱਲ੍ਹ ਬਹੁਤ ਆਸਾਨ ਹੋ ਗਿਆ ਹੈ ਅਤੇ ਇਹ ਇਹਨਾਂ ਵਾਸਤੇ ਤਾਂ ਖੇਡ ਹੀ ਬਣ ਗਈ ਹੈ ਅਤੇ ਉਸ ਤੋਂ ਇਲਾਵਾ ਇੱਥੇ ਹਰੇਕ ਪ੍ਰਕਾਰ ਦਾ ਜੀਵ ਜੰਤੂ ਪਾਏ ਜਾਂਦੇ ਹਨ ਪਾਣੀ ਦੇ ਵਿੱਚ ਵੀ ਬਹੁਤ ਵੱਡੇ ਅਤੇ ਬਹੁਤ ਛੋਟੇ ਤੋਂ ਲੈ ਕੇ ਹਰੇਕ ਪ੍ਰਕਾਰ ਦੇ ਜੰਤੂ ਪਾਏ ਜਾਂਦੇ ਹਨ ਜੋ ਕਿ ਵੱਖ ਵੱਖ ਪ੍ਰਕਾਰ ਦੇ ਹੁੰਦੇ ਹਨ ਹਵਾ ਦੇ ਵਿੱਚ ਵੀ ਉੱਡਣ ਵਾਲੇ ਜੀਵ ਪਾਏ ਜਾਂਦੇ ਹਨ ਅਤੇ ਧਰਤੀ ਦੇ ਉੱਤੇ ਤੁਰਨ ਵਾਲੇ ਜੀਵ ਵੀ ਪਾਏ ਜਾਂਦੇ ਹਨ ਅਤੇ ਕਈ ਜੀਵ ਜੋ ਕਿ ਪਾਣੀ ਅਤੇ ਧਰਤੀ ਦੋਵਾਂ 'ਤੇ ਜੀ ਸਕਦੇ ਹਨ ਇਸ ਪ੍ਰਕਾਰ ਦੇ ਵੀ ਪਾਏ ਜਾਂਦੇ ਹਨ